ਪਿੰਡਾਂ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਖੇਡ ਹੈ ਛੁਪਣ ਛੁਪਾਈ ਦੀ ਇਹ ਕਾਫੀ ਬੱਚੇ ਇੱਕੋ ਵਾਰ ਖੇਡ ਸਕਦੇ ਨੇ ਬੱਚੇ ਖੇਡ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਆਪਣੇ ਹੱਥਾਂ ਨੂੰ ਉਲਟਾ ਕਰਕੇ ਇੱਕ ਦੂਸਰੇ ਨਾਲ ਜੋੜ ਲੈਂਦੇ ਨੇ ਫਿਰ ਉਸ ਤੋਂ ਪਿੱਛੋਂ ਉਹਨਾਂ ਨੂੰ ਉੱਪਰ ਤੱਕ ਲਿਜਾ ਕੇ ਨੀਚੇ ਲੈ ਕੇ ਆਉਂਦੇ ਨੇ ਜਿਸ ਬੱਚੇ ਦਾ ਇੱਕ ਹੱਥ ਸਿੱਧਾ ਜਾਂ ਉਲਟਾ ਹੋਵੇ ਉਹ ਉਹਨਾਂ ਵਿੱਚੋਂ ਪਿੱਛੇ ਹਟ ਜਾਂਦਾ ਹੈ ਅਤੇ ਫਿਰ ਦੂਸਰੇ ਬੱਚੇ ਉਸ ਤਰ੍ਹਾਂ ਕਰਦੇ ਨੇ ਅਖੀਰ 'ਤੇ ਜਾ ਕੇ ਜਦੋਂ ਦੋ ਬੱਚੇ ਰਹਿ ਜਾਂਦੇ ਨੇ ਤਾਂ ਉਹਨਾਂ ਨਾਲੋਂ ਬਾਹਰ ਨਿਕਲੇ ਬੱਚਿਆਂ ਵਿੱਚੋਂ ਇੱਕ ਬੱਚਾ ਆਪਣਾ ਹੱਥ ਹੋਰ ਜੋੜ ਲੈਂਦਾ ਫਿਰ ਉਹਨਾਂ ਦੀ ਪੁੱਗਣ ਪੁਗਾਈ ਹੁੰਦੀ ਹੈ ਜਦੋਂ ਉਹਨਾਂ ਬੱਚਿਆਂ ਵਿੱਚ ਉਸ ਬੱਚੇ ਦੇ ਹੱਥ ਦੀ ਤਰ੍ਹਾਂ ਹੱਥ ਰਹਿ ਜਾਂਦਾ ਅਤੇ ਦੂਸਰੇ ਬੱਚੇ ਦਾ ਹੱਥ ਦੂਸਰੀ ਤਰ੍ਹਾਂ ਰਹਿ ਜਾਂਦਾ ਤਾਂ ਦੂਸਰਾ ਬੱਚਾ ਬਾਹਰ ਹੋ ਜਾਂਦਾ ਜਿਹਦਾ ਉਹਦੇ ਹ ਨਾਲ ਹੱਥ ਮਿਲਦਾ ਉਸ ਬੱਚੇ ਸਿਰ ਵਾਰੀ ਆ ਜਾਂਦੀ ਹੈ ਫਿਰ ਸਾਰੇ ਬੱਚੇ ਉਸਨੂੰ ਗਿਣਤੀ ਕਰਨ ਲਈ ਆਖਦੇ ਨੇ ਅਤੇ ਮੂੰਹ ਦੀਵਾਰ ਵੱਲ ਕਰਕੇ ਖੜ੍ਹਾ ਦਿੰਦੇ ਨੇ ਸਾਰੇ ਬੱਚੇ ਆਪਣਾ ਆਪਣਾ ਛੁਪਣਾ ਸ਼ੁਰੂ ਕਰ ਦਿੰਦੇ ਨੇ ਅਤੇ ਉਹ ਬੱਚਾ ਆਪਣੀ ਗਿਣਤੀ ਕਰਕੇ ਉਹਨਾਂ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਜਦੋਂ ਉਹ ਕਿਸੇ ਪਹਿਲੇ ਬੱਚੇ ਨੂੰ ਲੱਭ ਲੈਂਦਾ ਤਾਂ ਉਸ ਤੋਂ ਬਾਅਦ ਫਿਰ ਦੂਸਰਿਆਂ ਨੂੰ ਲੱਭਦਾ ਹੈ ਸਾਰਿਆਂ ਨੂੰ ਲੱਭਣ ਤੋਂ ਬਾਅਦ ਜਿਹੜੇ ਪਹਿਲੇ ਬੱਚੇ ਨੂੰ ਉਸਨੇ ਲੱਭਿਆ ਹੁੰਦਾ ਫਿਰ ਵਾਰੀ ਉਸਦੀ ਆ ਜਾਂਦੀ ਹੈ ਬਸ ਇਸ ਤਰ੍ਹਾਂ ਉਹ ਸਾਰਾ ਦਿਨ ਖੇਡਦੇ ਰਹਿੰਦੇ ਨੇ ਉਹਨਾਂ ਨੂੰ ਭੁੱਖ ਪਿਆਸ ਕੁਛ ਨਹੀਂ ਲੱਗਦੀ ਬਹੁਤ ਵਧੀਆ ਲੱਗਦਾ ਸਾਰਾ ਦਿਨ ਖੇਡਦੇ